ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਔਲਾ ਐਪ ਐਪ ਤੋਂ ਬੋਲ ਰਹੇ ਹੋ ਹਾਂਜੀ ਮੈਨੂੰ ਨਾ ਆਪਣੇ ਕੈਬ ਚਾਹੀਦੀ ਸੀਗੀ ਹਾਂਜੀ ਜੀ ਇਸ ਤਰ੍ਹਾਂ ਕਰਕੇ ਨਾ ਜੀ ਮੇਰੀ ਨਾ ਜੀ ਫ ਫਲਾਈਟ ਆ ਆਪਣੇ ਰਾਤ ਨੂੰ ਜੀ ਇੱਕ ਵਜੇ ਅਤੇ ਮੈਨੂੰ ਹੁਣ ਇੱਥੇ ਕੋਈ ਬੱਸ ਵਗੈਰਾ ਜਾਂ ਕੁਛ ਵੀ ਕੋਈ ਆਟੋ ਵਗੈਰਾ ਨਹੀਂ ਮਿਲ ਰਿਹਾ ਜੀ ਹਾਂਜੀ ਅਤੇ ਮੈਂ ਇੱਕ ਘੁੱਦਾ ਪਿੰਡ ਦੇ ਵਿੱਚ ਰਹਿੰਦਾ ਜੀ ਇੱਥੇ ਮੈਨੂੰ ਪਰੇਸ਼ਾਨੀ ਹੋ ਰਹੀ ਮਤਲਬ ਕੋਈ ਸ ਵਹੀਕਲ ਮਿਲ ਨਹੀਂ ਰਿਹਾ ਜੀ ਹਾਂਜੀ ਜੀ ਤੁਸੀਂ ਭੇਜ ਦਿਉਗੇ ਕੈਬ ਜੀ ਹਾਂਜੀ ਹਾਂਜੀ ਹੁਣੇ ਭੇਜ ਦਿਉ ਜੀ ਹਾਂਜੀ ਅਤੇ ਤੁਹਾਨੂੰ ਮੈਂ ਅਡਰੈਸ ਦੱਸ ਦਿੰਦਾ ਜੀ ਆਪਣਾ ਜੀ ਤੁਸੀਂ ਆਪਣੇ ਘੁੱਦਾ ਪਿੰਡ ਆ ਕੇ ਜੀ ਅਤੇ ਪੰਜ ਨੰਬਰ ਗਲੀ ਨੂੰ ਮੁੜਿਓ ਜੀ ਪਹਿਲਾ ਮੋੜ ਜੀ ਹਾਂਜੀ ਮੋੜ ਮੁੜ ਕੇ ਅਤੇ ਮੇਰਾ ਨਾਮ ਹਰਦੀਪ ਹਰਦੀਪ ਪਾਲ ਆ ਜੀ ਹਾਂਜੀ ਅਤੇ ਮੇਰੇ ਘਰ ਦੇ ਬਾਹਰ ਹੀ ਅਡਰੈਸ ਲਿਖਿਆ ਹੋਇਆ ਜੀ ਹਾਂਜੀ ਬਾਕੀ ਮੋੜ ਮੁੜ ਕੇ ਚੌਥਾ ਘਰ ਆਪਣਾ ਜੀ ਹਾਂਜੀ ਠੀਕ ਆ ਜੀ ਚਲੋ ਤੁਸੀਂ ਆ ਜਾਉ ਫਿਰ ਜੀ ਠੀਕ ਹੈ ਜੀ